ਮੈਨੂੰ ਪੇਂਟਿੰਗ ਕਰਨਾ ਬਹੁਤ ਪਸੰਦ ਹੈ ਪੇਂਟਿੰਗ ਕਰਨਾ ਮੇਰਾ ਬਚਪਨ ਤੋਂ ਹੀ ਸ਼ੌਕ ਰਿਹਾ ਹੈ ਮੈਂ ਬਚਪਨ ਤੋਂ ਹੀ ਪੇਂਟਿੰਗ ਕਰਦਾ ਆ ਰਿਹਾ ਹਾਂ ਪਹਿਲਾਂ ਮੈਂ ਜ਼ਿਆਦਾ ਵਧੀਆ ਪੇਂਟਿੰਗ ਨਹੀਂ ਕਰ ਪਾਉਂਦਾ ਸੀ ਪਰ ਮੈਂ ਹੁਣ ਹੌਲੀ ਹੌਲੀ ਆਪਣੀ ਪੇਂਟਿੰਗ ਵਿੱਚ ਬਹੁਤ ਜ਼ਿਆਦਾ ਸੁਧਾਰ ਕਰ ਲਿਆ ਹੈ ਹੁਣ ਮੈਂ ਬਹੁਤ ਵਧੀਆ ਪੇਂਟਿੰਗ ਬਣਾ ਲੈਂਦਾ ਹਾਂ ਮੇਰੀਆਂ ਬਣਾਈਆਂ ਪੇਂਟਿੰਗਾਂ ਬਾਜ਼ਾਰਾਂ ਵਿੱਚ ਵਧੀਆ ਕੀਮਤ ਵਿੱਚ ਵਿਕ ਰਹੀਆਂ ਹਨ ਮੈਨੂੰ ਹਰ ਸਮੇਂ ਪੇਂਟਿੰਗ ਵਿੱਚ ਰੁੱਝੇ ਰਹਿਣਾ ਪਸੰਦ ਹੈ ਇੱਕ ਪ੍ਰਭਾਵਸ਼ਾਲੀ ਪੇਂਟਿੰਗ ਬਣਾਉਣ ਦੇ ਵੱਖ ਵੱਖ ਤਰੀਕੇ ਹੁੰਦੇ ਹਨ ਮੇਰੀ ਪੇਂਟਿੰਗ ਨੂੰ ਦੇਖਣ ਲਈ ਉਸਨੂੰ ਸਮਝਣ ਦੀ ਕੋਸ਼ਿਸ਼ ਕਰਨਾ ਚਾਹੀਦਾ ਹੈ ਇਸ ਨਾਲ ਉਹ ਬਹੁਤ ਵਧੀਆ ਪ੍ਰਭਾਵਿਤ ਹੁੰਦੇ ਹਨ ਅੱਜ ਦੇ ਸਮੇਂ ਵਿੱਚ ਲੋਕ ਪੇਂਟਿੰਗ ਘੱਟ ਕਰਦੇ ਹਨ ਪਰ ਜੋ ਲੋਕ ਕਰਦੇ ਹਨ ਉਹ ਪੂਰੇ ਤਨ ਮਨ ਨਾਲ ਕਰਦੇ ਹਨ ਪਰ ਉਹ ਪੇਂਟਿੰਗ ਵਿੱਚ ਜਾਨ ਪਾ ਦਿੰਦੇ ਹਨ ਬਹੁਤ ਸਾਰੇ ਪ੍ਰਸਿੱਧ ਚਿੱਤਰਕਾਰ ਅਤੇ ਪੇਂਟਿੰਗ ਬਣਾਉਣ ਵਾਲੇ ਅਜਿਹੇ ਵੀ ਹੁੰਦੇ ਹਨ ਜੋ ਪੇਂਟਿੰਗ ਵਿੱਚ ਜਾਨ ਪਾ ਦਿੰਦੇ ਹਨ ਇੱਦਾਂ ਮਹਿਸੂਸ ਹੁੰਦਾ ਹੈ ਕਿ ਪੇਂਟਿੰਗ ਆਪ ਬੋਲ ਰਹੀ ਹੈ ਮੈਂ ਵੀ ਪੂਰੀ ਕੋਸ਼ਿਸ਼ ਕਰਦਾ ਹਾਂ ਕਿ ਮੇਰਾ ਨਾਮ ਵੀ ਉਹਨਾਂ ਪ੍ਰਸਿੱਧ ਚਿੱਤਰਕਾਰਾਂ ਵਿੱਚ ਆਵੇ ਇੱਕ ਪ੍ਰਭਾਵਸ਼ਾਲੀ ਪੇਂਟਿੰਗ ਬਣਾਉਣ ਦੇ ਵੱਖ ਵੱਖ ਤਰੀਕੇ ਹਨ ਪੇਂਟਿੰਗ ਦੀ ਪ੍ਰਭਾਵਸ਼ਾਲੀ ਜਾਂ ਅਕਰਸ਼ਣ ਇੱਕ ਚੰਗੇ ਪੇਂਟਰ 'ਤੇ ਨਿਰਭਰ ਹੁੰਦੀ ਹੈ ਮੈਂ ਜਿੱਥੇ ਘੁੰਮਣ ਲਈ ਜਾਂਦਾ ਹਾਂ ਤਾਂ ਉੱਥੇ ਹਮੇਸ਼ਾ ਆਉਣ ਵਾਲੀਆਂ ਥਾਂ ਯਾਦਾਂ ਲਈ ਉਸ ਸਥਾਨ ਦੀ ਤਸਵੀਰ ਜਨੂ ਜ਼ਰੂਰ ਬਣਾਉਂਦਾ ਹਾਂ ਪਰੰਤੂ ਹੁਣ ਮੈਂ ਇਹ ਕੋਸ਼ਿਸ਼ ਕਰਦਾ ਹਾਂ ਕਿ ਮੇਰੀ ਮੇਰੇ ਦੁਆਰਾ ਬਣਾਈਆਂ ਗਈਆਂ ਤਸਵੀਰਾਂ ਵਿੱਚ ਸਮਾਜਿਕ ਸੁਧਾਰਾਂ ਨੂੰ ਦਰਜਾ ਦਰਸਾਇਆ ਜਾ ਸਕੇ ਅਤੇ ਆਮ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਤਾਂ ਜੋ ਤਸਵੀਰਾਂ ਰਾਹੀਂ ਸਮਾਜ ਵਿੱਚ ਵਧੀਆ ਰਸਤੇ ਨੂੰ ਅਪਣਾ ਸਕਣ ਅਤੇ ਨੀ ਨਵੀਂ ਪੀੜ੍ਹੀ ਦੇ ਬੱਚੇ ਤਸਵੀਰ ਰਾਹੀਂ ਵਸਤੂਆਂ ਜਾ ਵਿਚਾਰਾਂ ਨੂੰ ਵਧੀਆ ਢੰਗ ਨਾਲ ਸਮਝ ਸਕਣ